ਹਾਂ ਮੈਂ ਟਰੈਕ 'ਤੇ ਗਿਆ ਸੀ ਮੇਰਾ ਇੱਕ ਹਫ਼ਤੇ ਦਾ ਸਫ਼ਰ ਸੀ ਮੇਰੇ ਨਾਲ ਮੇਰੇ ਦੋਸਤ ਵੀ ਗਏ ਸੀ ਜਦੋਂ ਆਪਾਂ ਸਾਰੇ ਪਹਾੜੀ 'ਤੇ ਪਹੁੰਚ ਗਏ ਉਸ ਟੈਮ ਸ਼ਾਮ ਦਾ ਟਾਇਮ ਸੀ ਸੂਰਜ ਢਲ ਰਿਹਾ ਸੀ ਢਲਦੇ ਹੋਏ ਸੂਰਜ ਦੀਆਂ ਕਿਰਨਾਂ ਪਹਾੜੀ ਉੱਤੇ ਸੁਨਹਿਰੀ ਰੰਗ 'ਚ ਚਮਕ ਰਹੀਆਂ ਸਨ ਇਹ ਦ੍ਰਿਸ਼ ਬੜਾ ਹੀ ਮਨਮੋਹਕ ਸੀ ਅਤੇ ਮੇਰੀ ਯਾਦ ਵਿੱਚ ਹਮੇਸ਼ਾ ਲਈ ਸ਼ਾਮਿਲ ਹੋ ਗਿਆ ਸ਼ਹਿਰ ਦੇ ਭੀੜ ਭੜੱਕੇ ਤੋਂ ਦੂਰ ਬੜੇ ਹੀ ਸਕੂਨ ਦਾ ਅਹਿਸਾਸ ਹੋਇਆ ਜਿਸ ਟਾਈਮ ਮੈਂ ਟਰੈਕਿੰਗ 'ਤੇ ਗਿਆ ਸੀ ਉਸ ਟਾਈਮ ਮੈਂ ਕੋਲੇਜ ਵਿੱਚ ਪੜ੍ਹਦਾ ਸੀ ਅਤੇ ਆਪਣੇ ਕੋਲੇਜ ਦੇ ਮਿੱਤਰਾਂ ਦੇ ਨਾਲ ਗਿਆ ਸੀ